ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਮੈਰਾਥੋਨਸ ਕਰਵਾਈਆਂ ਜਾਂਦੀਆਂ ਹਨ ਇਸ ਮੈਰਾਥੋਨ ਵਿੱਚ ਮੈਨੇ ਤਿੰਨ ਕਿਲੋਮੀਟਰ ਦੀ ਦੌੜ ਵਿੱਚ ਹਿੱਸਾ ਲਿਆ ਸੀ ਸਾਡੇ ਸਕੂਲ ਵਿੱਚ ਇੱਕ ਕਿਲੋਮੀਟਰ ਦੋ ਕਿਲੋਮੀਟਰ ਤਿੰਨ ਕਿਲੋਮੀਟਰ 'ਤੇ ਚਾਰ ਕਿਲੋਮੀਟਰ ਦੀਆਂ ਮੈਰਾਥੋਨ ਹੁੰਦੀਆਂ ਹਨ ਅਤੇ ਮੈਨੇ ਜਿਸ ਮੈਰਾਥੋਨ ਵਿੱਚ ਹਿੱਸਾ ਲਿਆ ਸੀ ਉਸ ਵਿੱਚੋਂ ਮੈਨੇ ਦੂਜਾ ਸਥਾਨ ਪ੍ਰਾਪਤ ਕੀਤਾ ਸੀ ਇਸ ਮੈਰਾਥੋਨ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਨ ਲਈ ਵੀ ਮੈਨੂੰ ਬਹੁਤ ਮਿਹਨਤ ਦੀ ਲੋੜ ਪਈ ਸੀ ਜਦੋਂ ਮੈਂ ਸਟਾਰਟਿੰਗ ਵਿੱਚ ਦੌੜਨਾ ਸ਼ੁਰੂ ਕਰਦੀ ਸੀ ਤਾਂ ਮੇਰੀਆਂ ਮਾਸਪੇਸ਼ੀਆਂ ਵਿੱਚ ਬਹੁਤ ਦਰਦ ਹੁੰਦਾ ਸੀ ਸ਼ੁਰੂਆਤ ਵਿੱਚ ਤਾਂ ਮੈਨੂੰ ਜਲਦੀ ਉੱਠਣਾ ਵੀ ਔਖਾ ਲੱਗਦਾ ਸੀ ਪਰ ਸਥਾਨ ਪ੍ਰਾਪਤ ਕਰਨ ਲਈ ਮੈਂ ਸੁਬਹਾ ਜਲਦੀ ਉੱਠ ਕੇ ਦੌੜਨ ਜਾਂਦੀ ਸੀ ਅਤੇ ਇੱਕ ਕਿਲੋਮੀਟਰ ਦੌੜ ਤੋਂ ਬਾਅਦ ਹੀ ਮੇਰੇ ਪੈਰ ਦੁੱਖਣ ਲੱਗ ਜਾਂਦੇ ਸਨ ਪਰ ਮੈਂ ਫੇਰ ਵੀ ਦੌੜਦੀ ਸੀ ਇਸ ਤੋਂ ਬਾਅਦ ਜਿਵੇਂ ਜਿਵੇਂ ਮੈਂ ਦੌੜਨ ਦੀ ਆਦਤ ਬਣਾਈ ਗਈ ਉਵੇਂ ਉਵੇਂ ਮੇਰਾ ਦਰਦ ਘੱਟਦਾ ਗਿਆ ਦੌੜਨ ਨਾਲ ਮੈਨੂੰ ਫੁਰਤੀਲਾਪਨ ਮਹਿਸੂਸ ਹੁੰਦਾ ਸੀ ਅਤੇ ਦੌੜਦੇ ਦੌੜਦੇ ਮੇਰੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਹੋ ਗਈਆਂ ਸਨ ਅਤੇ ਹੁਣ ਦੌੜਨ ਨਾਲ ਮੈਨੂੰ ਔਖਾ ਨਹੀਂ ਸੀ ਲੱਗਦਾ ਹੁਣ ਦੌੜਨਾ ਮੈਨੂੰ ਚੰਗਾ ਲੱਗਣ ਲੱਗ ਪਿਆ ਸੀ ਅਤੇ ਇਸ ਮੈਰਾਥੋਨ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਲਈ ਵੀ ਮੈਨੂੰ ਬਹੁਤ ਅਨੁਭਵ ਦੀ ਲੋੜ ਪਈ ਸੀ ਮੈਨੇ ਇਹ ਅਨੁਭਵ ਓਲੰਪਿਕ ਵਿੱਚ ਜਿੱਤੇ ਖਿਡਾਰੀਆਂ ਤੋਂ ਪ੍ਰਾਪਤ ਕੀਤਾ ਸੀ ਉਹ ਜਿਵੇਂ ਸੁਬਹਾ ਜਲਦੀ ਉੱਠ ਕੇ ਭੱਜਣ ਜਾਂਦੇ ਸਨ ਅਤੇ ਆਪਣੀ ਡਾਇਟ ਦਾ ਵੀ ਪੂਰਾ ਖਿਆਲ ਰੱਖਦੇ ਸਨ ਮੈਂ ਵੀ ਜਦੋਂ ਦੌੜਨ ਦੀ ਪ੍ਰੈਕਟਿਸ ਕਰਦੀ ਸੀ ਤਾਂ ਮੈਂ ਵੀ ਆਪਨੀ ਡਾਈਟ ਦਾ ਪੂਰਾ ਧਿਆਨ ਰੱਖਦੀ ਸੀ ਇਸ ਡਾਈਟ ਵਿੱਚ ਕੋਈ ਤਲਿਆ ਫਲਿਆ ਨਹੀਂ ਖਾਣਾ ਹੁੰਦਾ ਆਪਾਂ ਇਸ ਵਿੱਚ ਆਪਾਂ ਨੇ ਸਿਹਤਮੰਦ ਚੀਜ਼ਾਂ ਹੀ ਖਾਣੀਆਂ ਹੁੰਦੀਆਂ ਨੇ ਅਤੇ ਮੇਰਾ ਦੌੜ ਲਗਾਉਣ ਦਾ ਅਨੁਭਵ ਬਹੁਤ ਹੀ ਚੰਗਾ ਸੀ ਇਸ ਅਨੁਭਵ ਰਾਹੀਂ ਮੈਂ ਸਿੱਖਿਆ ਵੀ ਆਪਾਂ ਨੂੰ ਆਪਦੇ ਮਕਸਦ ਵਿੱਚ ਦ੍ਰਿੜ ਨਿਸ਼ਚੇ ਰੱਖਣਾ ਚਾਹੀਦਾ ਹੈ ਅਗਰ ਮੈਨੇ ਦ੍ਰਿੜ ਨਿਸ਼ਚੇ ਨਾ ਰੱਖਿਆ ਹੁੰਦਾ ਤਾਂ ਮੈਂ ਕਦੇ ਵੀ ਇਸ ਦੌੜ ਵਿੱਚ ਦੂਜਾ ਸਥਾਨ ਪ੍ਰਾਪਤ ਨਹੀਂ ਕਰ ਸਕਦੀ ਸੀ